ਮੋਹਾਲੀ ਜ਼ਿਲ੍ਹਾ ਬਹੁਤ ਸਾਰੇ ਧਰਮਾਂ ਅਤੇ ਰੀਤੀ ਰਿਵਾਜਾਂ ਨਾਲ ਭਰਿਆ ਹੋਇਆ ਹੈ ਇੱਥੇ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਉਨ੍ਹਾਂ ਦੇ ਪਹਿਰਾਵੇ ਖਾਣ ਪੀਣ ਅਤੇ ਉਨ੍ਹਾਂ ਦੇ ਰਹਿਣ ਸਹਿਣ ਤੋਂ ਉਨ੍ਹਾਂ ਦੇ ਧਰਮ ਦਾ ਪਤਾ ਚੱਲਦਾ ਹੈ ਇੱਥੇ ਜਿਵੇਂ ਕਿ ਮੋਹਾਲੀ ਜ਼ਿਲ੍ਹਾ ਪੰਜਾਬ ਵਿੱਚ ਪੈਂਦਾ ਹੈ ਅਤੇ ਉੱਥੋਂ ਦੇ ਲੋਕ ਰਲ਼ ਮਿਲ਼ ਕੇ ਰਹਿੰਦੇ ਹਨ ਅਤੇ ਹਰੇਕ ਤਿਉਹਾਰ ਇਕੱਠੇ ਮਨਾਉਂਦੇ ਹਨ ਇਸ ਤਰ੍ਹਾਂ ਸਾਨੂੰ ਉਨ੍ਹਾਂ ਦੇ ਭਾਈਚਾਰੇ ਰੀਤੀ ਰਿਵਾਜਾਂ ਅਤੇ ਭਾਵਨਾ ਦਾ ਪਤਾ ਚੱਲਦਾ ਹੈ ਉਨ੍ਹਾਂ ਉਨ੍ਹਾਂ ਦੇ ਬੱਚੇ ਵੱਡੇ ਵੱਡੇ ਸਾਰਿਆਂ ਨਾਲ ਰਲ਼ ਮਿਲ਼ ਕੇ ਰਹਿੰਦੇ ਹਨ ਉਨ੍ਹਾਂ ਨੂੰ ਹਰੇਕ ਤਿਉਹਾਰ ਦਾ ਬੜਾ ਹੀ ਉਤਸ਼ਾਹ ਹੁੰਦਾ ਹੈ ਅਤੇ ਉਹ ਬੜੇ ਖੁਸ਼ੀ ਖੁਸ਼ੀ ਸਾਰਿਆਂ ਨਾਲ ਆਪਣੇ ਭਾਵਨਾ ਨੂੰ ਭਾਵਨਾ ਨੂੰ ਪ੍ਰਗਟ ਕਰਦੇ ਹਨ ਅਤੇ ਹਰੇਕ ਤਿਉਹਾਰ ਨੂੰ ਆਪਸ ਵਿੱਚ ਮਨਾਉਂਦੇ ਹਨ ਜਿਵੇਂ ਕਿ ਮੋਹਾਲੀ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਉਹ ਆਪਣੇ ਰੀਤੀ ਰਿਵਾਜ ਅਤੇ ਆਪਣੇ ਤਿਉਹਾਰਾਂ ਨੂੰ ਇੱਕ ਦੂਜੇ ਨਾਲ਼ ਰਲ਼ ਮਿਲ਼ ਕੇ ਚੰਗੀ ਤਰ੍ਹਾਂ ਮਨਾਉਂਦੇ ਹਨ ਅਤੇ ਖੁਸ਼ੀ ਖੁਸ਼ੀ ਉਹਨਾਂ ਨਾਲ ਸਾਰਿਆਂ ਨਾਲ ਰਲ਼ ਮਿਲ਼ ਕੇ ਰਹਿੰਦੇ ਹਨ ਇੱਥੋਂ ਸਾਨੂੰ ਉਨ੍ਹਾਂ ਦੇ ਭਾਈਚਾਰੇ ਦਾ ਪਤਾ ਲੱਗਦਾ